ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਆ ਹਾਲ ਚਾਲ ਬਸ ਐਨ ਵਧੀਆ ਜੀ ਅੱਛਾ ਜੀ ਲੈ ਇਹ ਤਾਂ ਵਧੀਆ ਗੱਲ ਹੈ ਜੀ ਹਾਂਜੀ ਹਾਂਜੀ ਵਧੀਆ ਵਧੀਆ ਮਾਰਿਓ ਗੇੜਾ

ਅੱਛਾ ਜੀ ਓਕੇ ਭਾਅ ਜੀ ਦੇਖੋ ਫੇਰੀ ਵਾਲੇ ਤੋਂ ਤਾਂ ਸਬਜ਼ੀ ਲੈਣੀ ਓ ਨਹੀਂ ਚਾਹੀਦੀ ਇਹ ਜਿਹੜੇ ਫੇਰੀ ਵਾਲੇ ਆ ਨਾ ਇਹ ਤਾਂ ਜੀ ਪੁਰਾਣਾ ਮਾਲ ਲਿਆਉਂਦੇ ਆ ਹਫ਼ਤੇ ਹਫ਼ਤੇ ਦੀਆਂ ਕੱਠੀਆਂ ਸਬਜ਼ੀਆਂ ਚੱਕ ਲੈਂਦੇ ਮੰਡੀ ਤੋਂ ਇਹ ਕੁਆਂਟਲਾਂ ਦੇ ਹਿਸਾਬ ਨਾਲ ਉਹ ਫਿਰ ਉਹ ਜੀ ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਇ ਕਰਕੇ ਵੇਚੀ ਜਾਂਦੇ ਇਹਨਾਂ ਕੋਲ ਤਾਂ ਜੀ ਤਾਜ਼ੀ ਓ ਨਹੀਂ ਹੁੰਦੀ ਸਬਜ਼ੀ ਪੁਰਾਣੀਆਂ ਸਬਜ਼ੀਆਂ ਵੇਚਦੇ ਆ ਮੇਰੀ ਮੰਨੋ ਤੁਸੀਂ ਇੱਧਰ ਨੂੰ ਨਾ ਆਪਾਂ ਰੇਲਵੇ ਸਟੇਸ਼ਨ ਵੱਲ ਨੂੰ ਜਾਂਦੇ ਆ ਨਾ ਜਦੋਂ ਉੱਥੇ ਉਹ ਮਾਰਕੀਟ ਚ ਵਧੀਆ ਖੜਦੇ ਆ ਸਬਜ਼ੀ ਵਾਲੇ ਭਾਈ ਅੱਗੇ ਨੂੰ ਜਾ ਕੇ ਨਾ ਮਾੜਾ ਜਿਹਾ ਉਰਾ ਹੀ ਨਹੀਂ ਰੁਕਣਾ ਹੈਗਾ ਇੱਕ ਦੋ ਨਾ ਮੁਸਲਮਾਨ ਜਿਹੇ ਬਹਿੰਦੇ ਆ ਉਹ ਉਹਨਾਂ ਦੀ ਸਬਜ਼ੀ ਬੜੀ ਬੈਸਟ ਹੁੰਦੀ ਹੈ ਸਾਡੇ ਸਾਰੇ ਘਰ ਦੀ ਸਬਜ਼ੀ ਉੱਥੋਂ ਹੀ ਆਉਂਦੀ ਹੈ ਤਾਜ਼ੀ ਤਾਜ਼ੀ ਸਬਜ਼ੀ ਹੁੰਦੀ ਹੈ ਜੀ ਉਹ ਨਾ ਭਾਅ ਜੀ ਪਤਾ ਕਿਆ ਚੱਕਰ ਆ ਔਰਗੈਨਿਕ ਖੇਤੀ ਕਰਦੇ ਆ ਜੀ ਉਹ ਉਹਦੇ ਕਰਕੇ ਪੈਸਟੀਸਾਈਡਜ਼ ਨਹੀਂ ਡਾਲਦੇ ਜੀ ਉਹ ਜ਼ਿਆਦਾ ਹਾਂਜੀ ਪਿਓਰ ਸਬਜ਼ੀ ਹੁੰਦੀ ਹੈ ਜੀ ਐਨ ਮੈਂ ਕਹਿੰਦਾ ਤੁਸੀਂ ਖਾ ਕੇ ਦੇਖਿਓ ਤੁਸੀਂ ਆਪ ਸਿਫ਼ਤਾਂ ਕਰੋਂਗੇ ਬਸ ਇੰਨਾ ਕੁ ਲੋਸ ਆ ਵੀ ਸਬਜ਼ੀ ਹੁੰਦੀ ਥੋੜ੍ਹੀ ਮਹਿੰਗੀ ਹੁੰਦੀ ਆ ਥੋੜ੍ਹੀ ਜਿਹੀ ਹਾਂਜੀ ਬ ਬਾਕੀ ਬਾਜ਼ਾਰ ਨਾਲੋਂ ਨਾ ਰੇਟ ਥੋੜ੍ਹਾ ਜਿਹਾ ਜ਼ਿਆਦਾ ਹੀ ਹੁੰਦਾ ਉਹਨਾਂ ਦਾ ਹਾਂਜੀ ਹਾਂਜੀ ਐਨ ਤਾਜ਼ੀ ਹੁੰਦੀ ਹੈ ਜੀ ਮੈਂ ਕਹਿੰਦਾ ਚੀਜ਼ ਐਨ ਵਧੀਆ ਮਿਲਦੀ ਹੈ ਜੀ ਉੱਥੇ ਹਾਂਜੀ ਹੋਰ ਮਾਰਿਓ ਭਾਅ ਜੀ ਗੇੜਾ ਮਿਲੇ ਹੀ ਬਹੁਤ ਟਾਈਮ ਹੋ ਗਿਆ ਜੀ ਹਾਂਜੀ ਹਾਂਜੀ ਮਾਰਿਓ ਕੱਲ੍ਹ ਨੂੰ ਐਤਵਾਰ ਆ ਆ ਜਾਇਓ ਤੁਸੀਂ ਹਾਂਜੀ ਅੱਛਾ ਜੀ ਮੈਂ ਕਰ ਘਰ ਜੋਗੀਆਂ ਵੀ ਲੈ ਕੇ ਆਉਣੀਆ ਸਬਜ਼ੀਆਂ ਕੁਛ ਕੁ ਕੱਲ੍ਹ ਨੂੰ ਫਿਰ ਆਪਾਂ ਇਕੱਠੇ ਹੀ ਚੱਲਾਂਗੇ ਮੈਂ ਘੁਮਾ ਲਿਆਉਂਗਾ ਤੁਹਾਨੂੰ ਹਾਂਜੀ ਹਾਂਜੀ ਚਲੋ ਹਾਂਜੀ ਓ ਕੇ ਹਾਂਜੀ ਹਾਂਜੀ ਓ ਕੇ